ਜੋ ਮੈਨੂੰ ਲੱਗਦਾ ਅੱਜ ਕੱਲ੍ਹ ਸਭ ਤੋਂ ਵੱਧ ਵਰਤੀ ਜਾਣੀ ਐਪਸ ਜਿਹੜੀਆਂ ਹੈਗੀਆਂ ਉਹ ਰੇਲਵੇ ਰਿਗਾਰਡਿੰਗ ਬੈਂਕ ਐਪਸ ਟਵੀਟਰ ਫੇਸਬੁੱਕ ਵਟਸਐਪ ਜਿਹੜੀ ਕਾਫ਼ੀ ਡਿਫਰੈਂਟ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਐਪਸ ਅ ਉਹ ਬਹੁਤ ਸਾਰੀਆਂ ਯੂਜ ਹੁੰਦੀਆਂ ਨੇ ਸਮਾਰਟਫ਼ੋਨ ਤਾਂ ਆੱਫਕੋਰਸ ਇਹਨਾਂ ਦੇ ਲਈ ਚਾਹੀਦਾ ਹੀ ਚਾਹੀਦਾ ਹੁਣ ਸਮਾਰਟਫ਼ੋਨ ਦੀ ਕਿਉਂਕਿ ਹਰੇਕ ਚੀਜ਼ ਦੇ ਇੱਕ ਕੋਇਨ ਦੇ ਦੋ ਪਹਿਲੂ ਹੁੰਦੇ ਆ ਹਰੇਕ ਸਿੱਕੇ ਦੇ ਦੋ ਪਹਿਲੂ ਹੈ ਇਸ ਤਰ੍ਹਾਂ ਹੀ ਇਹ ਐਪਸ ਦੇ ਸਮਾਰਟਫ਼ੋਨ ਦੇ ਵੀ ਕੋਈ ਨਾ ਕੋਈ ਫ਼ਾਇਦੇ ਨੁਕਸਾਨ ਨੇ ਹੁਣ ਜਿਵੇਂ ਫ਼ਾਇਦਾ ਦੇਖੋ ਸਮਾਰਟਫ਼ੋਨ ਦਾ ਸਭ ਤੋਂ ਵੱਡਾ ਇਹ ਹੈ ਵੀ ਅਸੀਂ ਟੱਚ 'ਚ ਰਹਿੰਦੇ ਹਾਂ ਹਮੇਸ਼ਾ ਜਦੋਂ ਕੋਈ ਮੈਸੇਜ ਦੇਣਾ ਹੈਗਾ ਕੋਈ ਵਟਸਐਪ ਆਪਣਾ ਕੋਈ ਚੈਟ ਕਰਨੀ ਹੈ ਫਟਾਫਟ ਇਮੀਡੀਏਟਲੀ ਅਸੀਂ ਬੰਦੇ ਦੇ ਕੰਟੈਕਟ 'ਚ ਆ ਜਾਂਦੇ ਹਾਂ ਕਿੱਥੇ ਅਸੀਂ ਅੱਜ ਤੋਂ ਪੰਦਰਾਂ ਵੀਹ ਸਾਲ ਪਹਿਲਾਂ ਕਿਸੇ ਨੂੰ ਮਿਲਣਾ ਹੁੰਦਾ ਸੀਗਾ ਤਾਂ ਉਹਦੇ ਘਰ ਜਾਣਾ ਜਾਂ ਉਹਦੇ ਤੱਕ ਮੈਸੇਜ ਪਹੁੰਚਾਉਣ ਲਈ ਕਿੰਨੇ ਕਿੰਨੇ ਬੜੇ ਮਤਲਬ ਉਹ ਬੜਾ ਬੜਾ ਟਾਈਮ ਲੱਗਦਾ ਸੀਗਾ ਉਸ ਚੀਜ਼ ਨੂੰ ਕਿੱਥੇ ਤਾ ਕਿੱਥੇ ਕਿਤੇ ਤਾਂ ਹਫ਼ਤਾ ਵੀ ਲੱਗਦਾ ਸੀਗਾ ਹੁਣ ਅਗਰ ਫੋਰਨ 'ਚ ਵੀ ਬੰਦਾ ਬੈਠਾ ਪੰਜ ਸੌ ਪੰਦਰਾਂ ਸੌ ਕਿਲੋਮੀਟਰ ਦੂਰ ਵੀ ਬੈਠਾ ਤਾਂ ਵੀ ਇਨ ਟੱਚ ਬੜਾ ਈਜ਼ੀਲੀ ਹੋ ਜਾਂਦਾ ਤੁਸੀਂ ਆਪਣੀ ਪਿਕਚਰ ਸੈਂਡ ਕਰਨੀ ਹੈ ਦੂਜੇ ਦੀਆਂ ਵੀਡੀਓਜ਼ ਕੋਲਜ਼ ਕਰਨੀਆਂ ਉਹ ਬੜੇ ਅੱਛੇ ਤਰੀਕੇ ਨਾਲ ਹੋ ਜਾਂਦੀਆਂ ਮਤਲਬ ਰਿਸਪਾਂਸ ਬੜਾ ਫਟਾਫਟ ਹੋ ਗਿਆ ਅਤੇ ਕੋਈ ਬੰਦਾ ਬਾਹਰ ਗਿਆ ਹੋਵੇ ਤਾਂ ਸਾਨੂੰ ਉਹਦੀ ਕਮੀ ਇੰਨੀ ਜ਼ਿਆਦਾ ਮਹਿਸੂਸ ਨਹੀਂ ਹੁੰਦੀ ਕਮੀ ਤਾਂ ਮਹਿਸੂਸ ਹੁੰਦੀ ਹੀ ਹੁੰਦੀ ਹੈ ਕੋਈ ਗਿਆ ਪਰ ਜ਼ਿਆਦਾ ਨਹੀਂ ਹੋ ਪਾਉਂਦੀ ਕਿਉਂਕਿ ਅਸੀਂ ਰੋਜ਼ਾਨਾ ਉਹਦੇ ਨਾਲ ਇਨ ਟੱਚ ਹੈਗੇ ਹਾਂ ਹੁਣ ਨੈਚੁਰਲੀ ਜਿੱਥੇ ਫ਼ਾਇਦੇ ਆ ਉੱਥੇ ਨੁਕਸਾਨ ਵੀ ਹੋਣਗੇ ਹੁਣ ਨੁਕਸਾਨ ਤੋਂ ਸਭ ਤੋਂ ਵੱਡਾ ਇਹ ਹੀ ਨੁਕਸਾਨ ਹੈ ਕਿ ਲਗਾਤਾਰ ਹੀ ਬੰਦਾ ਕੰਟੀਨਿਊਟੀ ਜਿਹੜੇ ਇੱਕ ਸਰਵੇ ਆਇਆ ਵੀ ਉਹਦੇ 'ਚ ਅਪਰੋਕਸੀਮੇਟ ਇਹ ਕਹਿੰਦੇ ਕਿ ਛੇ ਘੰਟਿਆਂ ਬੰਦਾ ਜਿਹੜਾ ਆਪਣਾ ਟਾਈਮ ਹੈ ਜਿਹੜਾ ਇੱਕ ਪੂਰੇ ਦਿਨ ਦੇ ਵਿੱਚ ਉਹ ਇਹਨਾਂ ਐਪਸ 'ਤੇ ਮੋਬਾਇਲਸ 'ਤੇ ਸਮਾਰਟਫ਼ੋਨ 'ਤੇ ਯੂਜ ਕਰ ਰਿਹਾ ਕਿੰਨੀ ਵੇਸਟੇਜ਼ ਆੱਫ਼ ਟਾਈਮਿੰਗ ਹੈਗੀ ਇਹ ਜਿਹੜੀ 'ਚ ਪ੍ਰੋਡਕਟੀਵਿਟੀ ਹੋ ਸਕਦੀ ਸੀ ਉਹਦੇ ਵਿਦੇ ਵਿੱਚ ਇਹਦੇ ਵਿੱਚ ਹੀ ਲੱਗਿਆ ਹੋਇਆ ਰੀਲਸ ਦੇਖ ਰਿਹਾ ਸੋਸ਼ਲ ਮੀਡੀਆ ਯੂਜ ਕਰ ਰਿਹਾ ਫਿਰ ਉਹਦੇ ਨਾਲ ਮੋਬਾਇਲ ਦੇ ਨਾਲ ਇੱਕ ਨਾ ਇਕੱਲਾਪਣ ਬਹੁਤ ਆ ਰਿਹਾ ਬੰਦੇ 'ਚ ਜਾਂ ਆਪਾਂ ਨੋਰਮਲੀ ਕਹਿੰਦੇ ਡਿਪਰੈਸ਼ਨ ਆ ਰਹੀ ਹੈ ਉਹ ਡਿਪਰੈਸ਼ਨ ਦਾ ਰੀਜ਼ਨ ਹੀ ਇਹ ਹੀ ਹੈ ਕਿ ਵੀ ਅਸੀਂ ਕਿਸੇ ਨਾਲ ਮਿਲਦੇ ਨਹੀਂ ਗੱਲਬਾਤ ਨਹੀਂ ਕਰਦੇ ਉਹ ਫਿਰ ਹੌਲੀ ਹੌਲੀ ਕਰਕੇ ਡਿਪਰੈਸ਼ਨ ਆਉਣਾ ਸ਼ੁਰੂ ਹੋ ਜਾਂਦਾ ਊ ਵਾ ਰਿਹਾ ਬੰਦਾ ਨਾ ਉਹਨੂੰ ਇੱਕ ਨਾ ਨੋਰਮਲੀ ਵਰਡ ਯੂਜ਼ ਹੁੰਦਾ ਪੋਪਕੋਨ ਮਾਇੰਡ ਇਹ ਜਿਹੜਾ ਸਮਾਰਟਫ਼ੋਨ ਆ ਇੱਕ ਪੋਪਕੋਨ ਮਾਈਂਡ ਕ੍ਰੀਏਟ ਕਰ ਰਹੇ ਆ ਵੀ ਬੰਦਾ ਨਾ ਸਟੇਬਿਲਿਟੀ ਨਹੀਂ ਹੈਗੀ ਮਾਇੰਡ ਦੇ ਵਿੱਚ ਇੱਕ ਨਾਲ ਜੁੜਨ ਦੀ ਉਹ ਨਹੀਂ ਹੈਗੀ ਵੀ ਕਿੱਥੇ ਬੈਠਾ ਤਾਂ ਆਰਾਮ ਨਾਲ ਬੈਠਾ ਉਹਦੇ ਮਨ ਦੇ ਵਿੱਚ ਭਟਕਾਓ ਬਹੁਤ ਹੈ ਕਦੇ ਇਹ ਵੀ ਸੋਚ ਰਿਹਾ ਮੈਂ ਆਹ ਵੀ ਕਰ ਲਾਂ ਦਫਤਰ ਜਾਂਦਾ ਘਰ ਦੀ ਸੋਚ ਹੈ ਘਰ ਜਾਂਦਾ ਦਫਤਰ ਦੀ ਸੋਚ ਹੈ ਫਿਰ ਮਾਰਕੀਟ ਦੀ ਸੋਚ ਹੈ ਬਹੁਤ ਜ਼ਿਆਦਾ ਇਸ ਤਰ੍ਹਾਂ ਮਾਇੰਡ ਜਿਹੜਾ ਡਾਈਵਰਟ ਹੋਇਆ ਪਿਆ ਇਹਨੂੰ ਕਹਿੰਦੇ ਪੋਪਕੋਨ ਮਾਈਂਡ ਉਹ ਜਿਹੜਾ ਇਹ ਕ੍ਰੀਏਟ ਕਰ ਰਿਹਾ